ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬੀ ਹਿੰਦੀ ਬੈਂਗੋਲੀ ਬਿਹਾਰੀ ਮਰਾਠੀ ਇਹ ਸਾਰੀਆਂ ਭਾਸ਼ਾਵਾਂ ਹਰ ਇੱਕ ਤੋਂ ਅਲੱਗ ਹਨ ਅਤੇ ਜ਼ਿਆਦਾਤਰ ਭਾਸ਼ਾ ਦੀ ਵਰਤੋਂ ਪੰਜਾਬੀ ਅਤੇ ਹਿੰਦੀ ਦੀ ਹੁੰਦੀ ਹੈ